ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਖੇਡਾਂ ਖੇਡਣ ਦਾ ਜ਼ਮੀਨ ਅਸਮਾਨ ਦਾ ਅੰਤਰ ਹੈ ਕਿਉਂਕਿ ਅਗਰ ਦੇਖਿਆ ਜਾਵੇ ਤਾਂ ਪਿੰਡਾਂ ਵਿੱਚ ਖੇਡਣ ਦੇ ਉਪਕਰਣ ਉਨੀਂ ਚੰਗੀ ਤਰ੍ਹਾਂ ਉਪਲਬਧ ਨਹੀਂ ਹੁੰਦੇ ਹਨ ਜਿਵੇਂ ਸ਼ਹਿਰਾਂ ਦੇ ਵਿੱਚ ਹੁੰਦੇ ਹਨ ਸ਼ਹਿਰਾਂ ਵਿੱਚ ਬੱਚਿਆਂ ਨੂੰ ਖੇਡਣ ਲਈ ਵਧੀਆ ਕੋਚ ਵੀ ਉਪਲਬਧ ਕਰਾਏ ਜਾਂਦੇ ਹਨ ਤਾਂ ਕਿ ਉਸ ਦੇ ਖੇਡਣ ਦੇ ਤਰੀਕੇ ਨੂੰ ਹੋਰ ਚੰਗੀ ਤਰ੍ਹਾਂ ਅੱਗੇ ਵਧਾਇਆ ਜਾ ਸਕੇ ਪਰ ਪਿੰਡਾਂ ਵਿੱਚ ਇੰਨੀ ਫੈਸੀਲੀਟੀ ਨਹੀਂ ਮਿਲਦੀ ਹੈ ਕਿਉਂਕਿ ਉਸ ਵਿੱਚ ਡੈਵੇਲਪਮੈਂਟ ਦਾ ਧਿਆਨ ਥੋੜ੍ਹਾ ਘੱਟ ਰੱਖਿਆ ਜਾਂਦਾ ਹੈ ਅਤੇ ਪਿੰਡਾਂ ਵਿੱਚ ਚੰਗੇ ਗਰਾਊਂਡ ਵੀ ਨਹੀਂ ਹੁੰਦੇ ਹਨ ਅਤੇ ਬੱਚੇ ਜਿਸ ਵਿੱਚ ਉਨੀਂ ਚੰਗੀ ਤਰ੍ਹਾਂ ਖੇਡ ਨਹੀਂ ਖੇਡ ਸਕਦੇ ਹਨ ਅਤੇ ਆਪਣੇ ਆਪ ਨੂੰ ਅੱਗੇ ਨਹੀਂ ਵਧਾ ਸਕਦੇ ਹਨ ਸ਼ਹਿਰਾਂ ਵਿੱਚ ਬੱਚੇ ਇੱਕ ਚੰਗੇ ਗਰਾਊਂਡ ਵਿੱਚ ਚੰਗੇ ਕੋਚ ਦੇ ਅੰਡਰ ਬਹੁਤ ਵਧੀਆ ਖੇਡ ਖੇਡਦੇ ਹਨ ਅਤੇ ਉਹ ਸਿੱਖ ਵੀ ਜਾਂਦੇ ਹਨ ਉਹਨਾਂ ਕੋਲ ਸਾਰੇ ਸੇਫਟੀ ਦੇ ਉਪਕਰਣ ਵੀ ਮੌਜੂਦ ਹੁੰਦੇ ਹਨ ਜਿਸ ਨਾਲ਼ ਉਹਨਾਂ ਨੂੰ ਸੱਟ ਲੱਗਣ ਦਾ ਵੀ ਡਰ ਨਹੀਂ ਰਹਿੰਦਾ ਹੈ ਅਤੇ ਉਹ ਨਿਧੜਕ ਹੋ ਕੇ ਖੇਡ ਖੇਡਦੇ ਹਨ